ਮੌਜੂਦਾ ਸਮੇਂ ਦਾ ਦੇਖਿਆ ਜਾਵੇ ਤਾਂ ਭਾਰਤੀ ਆਵਾਜਾਈ ਪ੍ਰਣਾਲੀ ਬਹੁਤ ਵਧੀਆ ਹੈ ਪੁਰਾਤਨ ਸਮੇਂ ਵਿੱਚ ਲੋਕਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਵਿੱਚ ਜਾਣ 'ਤੇ ਬਹੁਤ ਔਖਾਈ ਹੁੰਦੀ ਸੀ ਪੁਰਾਤਨ ਸਮੇਂ ਵਿੱਚ ਉਨੀ ਆਧੁਨਿਕ ਪਰਨਾ ਆਵਾਜਾਈ ਪ੍ਰਣਾਲੀ ਨਹੀਂ ਸੀ ਜਿੰਨੀ ਕਿ ਅੱਜ ਹੈ ਅੱਜ ਦੇ ਸਮੇਂ ਵਿੱਚ ਆਧੁਨਿਕ ਟੈਕਨੋਲਜੀ ਆਉਣ ਦੇ ਕਾਰਨ ਪਰਾ ਆਵਾਜਾਈ ਪ੍ਰਣਾਲੀ ਵਿੱਚ ਬਹੁਤ ਸੁਧਾਰ ਆਇਆ ਹੈ ਅੱਜ ਕੱਲ੍ਹ ਇਹ ਐਰੋਪਲੇਨ ਅਤੇ ਮੈਟਰੋ ਆਦਿ ਟ੍ਰੇਨਾਂ ਚੱਲ ਪਈਆਂ ਹਨ ਜਿਸ ਦੀ ਵਜ੍ਹਾ ਕਰਕੇ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਵਿੱਚ ਕੋਈ ਮੁਸ਼ਕਿਲ ਨਹੀਂ ਆਉਂਦੀ ਇਸ ਤੋਂ ਇਲਾਵਾ ਭਾਰਤੀ ਸਰਕਾਰ ਨੇ ਬੱਸਾਂ ਆਦਿ ਦੀ ਫੈਸਿਲਿਟੀ ਵੀ ਦਿੱਤੀ ਹੋਈ ਹੈ ਇਸ ਤੋਂ ਇਲਾਵਾ ਹੋਰ ਵੀ ਵ ਇਨੋਵੇਸ਼ਨਸ ਹੋ ਰਹੀਆਂ ਹਨ ਟਰਾਂਸਪੋਰਟੇਸ਼ਨ ਦੇ ਵਿੱਚ ਜਿਸ ਦਾ ਕਰਕੇ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਵਿੱਚ ਜਾਣ ਦੀ ਕੋਈ ਔਖਾਈ ਨਹੀਂ ਆਉਂਦੀ ਮੈਂ ਖੁਦ ਦਾ ਹੀ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜਿਵੇਂ ਕਿ ਮੈਂ ਹਰ ਰੋਜ਼ ਆਪਣੇ ਕੋਲਜ਼ ਜਾਣ ਵਾਸਤੇ ਸਰਕਾਰੀ ਬੱਸ ਜਾਂ ਫਿਰ ਪ੍ਰਾਈਵੇਟ ਬੱਸ ਦਾ ਇਸਤੇਮਾਲ ਕਰਦੀ ਹਾਂ ਮੈਨੂੰ ਉਸ 'ਤੇ ਆਉਣਾ ਜਾਣਾ ਔਖਾ ਹੋ ਜਾਂਦਾ ਕਿਉਂਕਿ ਮੇਰੇ ਕੋਲ ਹੋਰ ਕੋਈ ਸਾਧਨ ਨਾ ਹੋਣ ਕਰਕੇ ਮੈਂ ਆਪਣੇ ਸਰਕਾਰੀ ਜਾਂ ਫਿਰ ਪ੍ਰਾਈਵੇਟ ਬੱਸ 'ਤੇ ਰੋਜ਼ਾਨਾ ਆਪਣੇ ਸਕੂਲ ਕਾਲ ਆਉਂਦੀ ਹਾਂ ਇਸ ਤੋਂ ਇਲਾਵਾ ਇਸ ਦੇ ਕੁਝ ਨੁਕਸਾਨ ਵੀ ਹਨ ਭਾਰਤੀ ਆਵਾਜਾਈ ਪ੍ਰਣਾਲੀ ਦੇ ਵਧਣ ਕਾਰਨ ਪੋਲਿਊਸ਼ਨ ਅਤੇ ਸ਼ੌਰ ਪ੍ਰਦੂਸ਼ਣ ਹੋਇਆ ਹੈ ਇਸ ਤੋਂ ਇਲਾਵਾ ਬੱਸਾਂ ਵਿੱਚ ਆਉਣ ਜਾਣ ਦੇ ਕਈ ਵਾਰ ਸਾਨੂੰ ਭੀੜ ਭੜੱਕੇ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦੇ ਨਾਲ ਕਈ ਵਾਰ ਸਾਨੂੰ ਸਮ ਖੜ੍ਹੇ ਹੋ ਕੇ ਵੀ ਆਉਣਾ ਪੈਂਦਾ ਹੈ ਅਤੇ ਕਈ ਵਾਰ ਸਾਡਾ ਸਮਾਂ ਵੀ ਖ਼ਰਾਬ ਹੁੰਦਾ ਹੈ ਕਦੇ ਕਦੇ ਘੰਟਾ ਘੰਟਾ ਬੱਸ ਦਾ ਵੇਟ ਵੀ ਕਰਨਾ ਪੈਂਦਾ ਜਿਸ ਦਾ ਕਰਕੇ ਮੈਨੂੰ ਬਹੁਤ ਮੁਸ਼ਕਿਲ ਉਠਾਉਣੀ ਪੈਂਦੀ ਹੈ ਇਸ ਦੇ ਨਾਲ ਥੋੜ੍ਹਾ ਸੁਧਾਰ ਤਾਂ ਹੋਇਆ ਹੈ ਪਰ ਇਸ ਦੇ ਨਾਲ ਇਸ ਦੀਆਂ ਕੁਝ ਨੁਕਸਾਨ ਵੀ ਹੋਏ ਹਨ ਆਵਾਜਾਈ ਪ੍ਰਣਾਲੀ ਅੱਜ ਦੇ ਟੈਮ ਵਿੱਚ ਬਹੁਤ ਵਧੀਆ ਹੋ ਗਈ ਆ ਪਰ ਫਿਰ ਵੀ ਕਿਤੇ ਨਾ ਕਿਤੇ ਹਜੇ ਇਸ ਦੇ ਵਿੱਚ ਕਮੀ ਹੈ